ਹਾਂਜੀ ਦੱਸੋ ਹਾਂਜੀ ਜਿਵੇਂ ਆਪਣੇ ਕੋਲ ਬੱਚਿਆਂ ਲਈ ਬਹੁਤ ਜ਼ਿਆਦਾ ਇੰਟਰਾਸਟਿੰਗ ਐਕਟੀਵਿਟੀਜ਼ ਹੈਗੀਆਂ ਜਿਵੇਂ ਉਦੇ ਵਿੱਚ ਹੋ ਗਿਆ ਭੰਗੜਾ ਸਵੀਮਿੰਗ ਪੂਲ ਬੈਡਮਿੰਟਨ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਹੋਰ ਵੀ ਬਹੁਤ ਸਾਰੀਆਂ ਹਾਂਜੀ ਕਲਾਸਿਸ ਦਾ ਟੈਮ ਹੈਗਾ ਮੋਰਨਿੰਗ ਦੇ ਵਿੱਚ ਲੱਗਦੀਆਂ ਈਵਨਿੰਗ ਦੇ ਵਿੱਚ ਲੱਗਦੀਆਂ ਐਂਡ ਜਿਹੜਾ ਹੈਗਾ ਆਫਟਰਨੂਨ ਜਿਹੜਾ ਹੈਗਾ ਗਾ ਕਲਾਸਿਸ ਦਾ ਬ੍ਰੇਕ ਹੁੰਦਾ ਕਿਉਂਕਿ ਉਸ ਟੈਮ ਗਰਮੀ ਬਹੁਤ ਜ਼ਿਆਦਾ ਹੁੰਦੀ ਹੈਗੀ ਅਤੇ ਵੈਸੇ ਬੱਚੇ ਸੁਬਹ ਜ਼ਿਆਦਾ ਇੰਜੋਏ ਕਰਦੇ ਆ ਸ਼ਾਮੀ ਵੀ ਜ਼ਿਆਦਾ ਜਾ ਇੰਜੋਏ ਕਰਦੇ ਆ ਦੁਪਹਿਰ ਦੇ ਨਾਲੋਂ ਸੋ ਬ ਅ ਸਾਡੇ ਜਿਹੜਾ ਹੈਗਾ ਹਾਂਜੀ ਹਾਂਜੀ ਹਾਂਜੀ ਮੈਮ ਇਹ ਸਾਰੀਆਂ ਸਾਰੀਆਂ ਸੁਵਿਧਾਵਾਂ ਸਾਡੇ ਕੋਲ ਹੈਗੀਆਂ ਨਾ ਤੁਸੀਂ ਇੱਕ ਵਾਰੀ ਵਿਜਿਟ ਕਰਕੇ ਦੇਖੋ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਵੀ ਸਾਰਾ ਕੁਛ ਹੈਗਾ ਫਿਰ ਤੁਸੀਂ ਆਪਣੇ ਬੱਚੇ ਨੂੰ ਜਿਹੜਾ ਹੈਗਾ ਇੱਥੇ ਐਡ ਅ ਛੱਡ ਜਿਓ ਹਾਂਜੀ ਹਾਂਜੀ ਜੇ ਤੁਸੀਂ ਬੱਚੇ ਇਤ ਬੱਚੇ ਇੱਥੇ ਆਉਣਗੇ ਉਨ੍ਹਾਂ ਦਾ ਬਹੁਤ ਜੀਅ ਲੱਗੇਗਾ ਬੱਚੇ ਬਹੁਤ ਖੁਸ਼ ਹੋਣਗੇ ਇੱਕ ਦੂਜੇ ਨਾਲ ਰਹਿਣਗੇ ਬਹੁਤ ਬੱਚੇ ਆਉਂਦੇ ਆ ਜੀ ਇੱਥੇ ਹਾਂਜੀ ਹਾਂਜੀ ਜ਼ਰੂਰ ਕਰ ਸਕਦੇ ਹੋ ਇਸੇ ਇੱਥੇ ਸਰਵਿਸ ਦੇਣ ਦੇ ਨਾਲ ਨਾਲ ਅਸੀਂ ਕੋਂਪੀਟੀਸ਼ਨ ਵੀ ਕਰਵਾਉਂਦੇ ਹੈਗੇ ਹਾਂ ਜੀ ਬੱਚੇ ਸਟੇਟ ਲੈਵਲ ਤੱਕ ਨੈਸ਼ਨਲ ਲੈਵਲ ਤੱਕ ਵੀ ਇੰਟਰਨੈਸ਼ਨਲ ਲੈਵਲ ਤੱਕ ਵੀ ਬੱਚੇ ਖੇਡੇ ਹੋਏ ਗਏ ਹੋਏ ਹੈਗੇ ਜੀ ਤੁਸੀਂ ਬੱਚੇ 'ਤੇ ਜੀ ਆਪਾਂ ਤਿੰਨ ਘੰਟੇ ਸੁਬਹ ਲਾਉਣੇ ਹੈਗੇ ਆ ਜੀ ਅਤੇ ਜੇ ਤੁਸੀਂ ਈਵਨਿੰਗ ਦਾ ਸੈਸ਼ਨ ਲੈਂਦੇ ਹੋ ਤਾਂ ਤਿੰਨ ਘੰਟੇ ਈਵਨਿੰਗ ਨੂੰ ਲੱਗਣਗੇ ਅਤੇ ਫੀਸ ਜਿਹੜੀ ਹੈਗੀ ਆ ਬੱਚੇ ਦੀ ਫੀਸ ਹੈਗੀ ਆ ਬੱਚੇ ਦੀ ਜੀ ਪੰਜ ਹਜ਼ਾਰ ਜੇ ਤੁਸ ਜਿਹੜੀ ਵੀ ਤੁਸੀਂ ਐਕਟੀਵਿਟੀ 'ਚ ਪਾਉਣਾ ਚਾਹੁੰਦੇ ਹੋ ਫਿਰ ਤੁਹਾਨੂੰ ਹਾਂਜੀ ਹਾਂਜੀ ਜ਼ਰੂਰ ਕਰਾਂਗੇ ਜੀ ਫੋਨ ਕਿਉਂ ਤੁਸੀਂ ਪਹਿਲਾਂ ਆਏ ਹੋ ਫਿਰ ਤੁਹਾਨੂੰ ਇਡਸਕਾਊਂਟ ਤਾਂ ਮਿਲੇਗਾ ਹੀ ਜ਼ਰੂਰ ਮਿਲੇਗਾ ਜੀ ਜਿੰਨੇ ਤੁਸੀਂ ਬੱਚੇ ਵੱਧ ਲੈ ਕੇ ਆਉਗੇ ਉਸ ਹਿਸਾਬ ਨਾਲ ਤੁਹਾਡੇ ਬੱਚੇ ਦਾ ਡਿਸਕਾਊਂਟ ਆ ਜਿਹੜਾ ਜੀ ਉਹ ਮਿਲਦਾ ਜਾਊਗਾ ਤੁਸੀਂ ਅੱਜ ਸ਼ਾਮ ਤੱਕ ਆ ਜਾਓ ਅੱਜ ਵਿਜਿਟ ਕਰ ਲਓ ਪਹਿਲਾਂ ਤੁਸੀਂ ਦੇਖੋ ਦੋ ਦਿਨ ਜੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਵੀ ਨਹੀਂ ਭਰੋਸਾ ਹੋ ਰਿਹਾ ਤੁਸੀਂ ਦੋ ਦਿਨ ਪਹਿਲਾਂ ਬੱਚੇ ਨੂੰ ਦੇਖਿਓ ਡੈਮੋ ਕਲਾਸਿਸ ਦਿਵਾਇਓ ਫਿਰ ਜੇ ਤੁਹਾਨੂੰ ਲੱਗਿਆ ਫਿਰ ਤੁਸੀਂ ਬੱਚੇ ਦੀ ਐਡਮਿਸ਼ਨ ਕਰਾਇਓ ਹਾਂਜੀ ਹਾਂਜੀ ਸ਼ਾਮ ਤੱਕ ਮਿਲੋ ਜ਼ਰੂਰ ਕਿਤੇ ਵੀ ਜੇ ਬੱਚੇ ਨਾਲ ਰਿਲੇਟਿਡ ਲੈਕੇ ਤੁਹਾਨੂੰ ਬੱਚੇ ਬਾਰੇ ਜੇ ਤੁਸੀਂ ਘਰ ਹੋਂ ਗਿਆ ਬੱਚਾ ਇੱਥੇ ਸਾਡੇ ਕੋਲ ਕੁਛ ਪੁੱਛਣਾ ਹੈਗਾ ਤੁਸੀਂ ਕਦੋਂ ਵੀ ਸਾਡੇ ਆਫਿਸ ਦੇ ਵਿੱਚ ਫੋਨ ਲਾ ਕੇ ਸਾਨੂੰ ਪੁੱਛ ਸਕਦੇ ਹੈਗੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਗੀ ਹਾਂਜੀ ਬੱਚੇ ਬੱਚੇ ਦੀ ਹੈਲਥ ਤੋਂ ਉੱਪਰ ਕੁਛ ਨਹੀਂ ਗਾ ਸਾਡੇ ਵੀ ਇਸ ਬੱਚੇ ਦੀ ਹੈਲਥ ਉੱਪਰ ਬਹੁਤ ਜ਼ਿਆਦੀ ਕੇਅਰ ਕੀਤੀ ਜਾਂਦੀ ਹੈ ਬੱਚਾ ਇਸ ਤਾਂ ਬੱਚਾ ਆ ਕੇ ਆਪਣੇ ਘਰ ਵਰਗੇ ਮਾਹੌਲ ਫੀਲ ਕਰਦਾ ਉਸ ਨੂੰ ਲੱਗਦਾ ਨਹੀਂ ਵੀ ਮੈਂ ਇੱਥੇ ਕੁਛ ਸਿੱਖਣ ਆ ਰਿਆ ਉਸ ਨੂੰ ਐਂ ਲੱਗਦਾ ਮੈਂ ਇੱਥੇ ਇੰਜੋਏ ਕਰਾਂ ਅ ਨ ਕਾਨ ਕਰ ਰਿਆ ਗਾ ਅਤੇ ਫਿਰ ਉਹ ਇੰਜੋਏ ਕਰਦਾ ਕਰਦਾ ਉਹ ਆਪਣੀ ਲਾਈਫ ਦੇ ਵਿੱਚ ਬਹੁਤ ਕੁਛ ਸਿੱਖ ਜਾਂਦਾ ਉਹਨੂੰ ਪਤਾ ਵੀ ਨਹੀਂ ਲੱਗਦਾ ਹਾਂਜੀ ਠੀਕ ਹੈ ਥੈਂਕਯੂ ਥੈਂਕਯੂ